ਹੁਣ ਜਿੱਦਾਂ ਭੰਗੜੇ ਦੇ ਬਹੁਤ ਸਟੈਪ ਹਨ ਪਰ ਉਹਨਾਂ ਵਿੱਚੋਂ ਕੁਝ ਸਟੈਪ ਜਿਹੜੇ ਕਿ ਵਿਆਹ ਸ਼ਾਦੀਆਂ ਵਿੱਚ ਕੀਤੇ ਜਾਂਦੇ ਹਨ ਜਿਵੇਂ ਤਿੱਲੇ ਧਮਾਲ ਸਿੱਧਾ ਝਾਫ ਫੁੱਟੇ ਅਤੇ ਮਿਰਗੀ ਤਿੱਲੇ ਸਟੈੱਪ ਵਿੱਚ ਹੱਥ ਉੱਚੇ ਕਰਕੇ ਅਤੇ ਪੈਰ ਨੂੰ ਥੋੜ੍ਹਾ ਉਠਾ ਕੇ ਨੱਚਿਆ ਜਾਂਦਾ ਹੈ ਧਮਾਲ ਭੰਗੜੇ ਦਾ ਸਭ ਤੋਂ ਜੋਸ਼ ਭਰਿਆ ਸਟੈਪ ਹੁੰਦਾ ਹੈ ਜਿਸ ਵਿੱਚ ਪੈਰਾਂ ਨੂੰ ਉੱਚਾ ਉਠਾ ਕੇ ਜ਼ਮੀਨ 'ਤੇ ਮਾਰਿਆ ਜਾਂਦਾ ਹੈ ਸਿੱਧਾ ਸਟੈਪ ਸਭ ਤੋਂ ਆਸਾਨ ਹੁੰਦਾ ਹੈ ਜਿਸ ਵਿੱਚ ਹੱਥਾਂ ਅਤੇ ਪੈਰਾਂ ਨੂੰ ਇੱਕ ਲੇਹ ਵਿੱਚ ਹਿਲਾਇਆ ਜਾਂਦਾ ਹੈ ਝਾਫ ਵਿੱਚ ਪੈਰਾਂ ਨੂੰ ਹੌਲੀ ਹੌਲੀ ਅੱਗੇ ਪਿੱਛੇ ਰਗੜਦੇ ਹੋਏ ਨੱਚਿਆ ਜਾਂਦਾ ਹੈ ਭੰਗੜਾ ਪੰਜਾਬੀ ਸੱਭਿਆਚਾਰ ਵਿੱਚ ਬਹੁਤ ਯੋਗਦਾਨ ਪਾਉਂਦਾ ਹੈ ਭੰਗੜਾ ਖੁਸ਼ੀ ਦਾ ਪ੍ਰਤੀਕ ਹੈ ਇਹ ਵਿਆਹਾਂ ਤਿਉਹਾਰਾਂ ਜਿਵੇਂ ਵਿਸਾਖੀ ਲੋਹੜੀ ਅਤੇ ਹੋਰ ਖੁਸ਼ੀਆਂ ਦੇ ਮੌਕਿਆਂ 'ਤੇ ਕੀਤਾ ਜਾਂਦਾ ਹੈ ਪੁਰਾਣੇ ਸਮਿਆਂ 'ਚ ਕਿਸਾਨ ਆਪਣੀ ਫਸਲ ਦੀ ਕਟਾਈ ਤੋਂ ਬਾਅਦ ਭੰਗੜਾ ਕਰਕੇ ਆਪਣੀ ਖੁਸ਼ੀ ਮਨਾਉਂਦੇ ਸਨ ਭੰਗੜਾ ਲੋਕਾਂ ਨੂੰ ਇਕੱਠੇ ਲਿਆਉਂਦਾ ਹੈ ਜਿਸ ਨਾਲ ਭਾਈਚਾਰੇ ਅਤੇ ਸੱਭਿਆਤਕ ਸੰਸਕਾਰ ਮਜ਼ਬੂਤ ਹੁੰਦੇ ਹਨ ਭੰਗੜਾ ਦੁਨੀਆਂ ਭਰ ਵਿੱਚ ਪੰਜਾਬੀ ਸੱਭਿਆਚਾਰ ਦੀ ਪਹਿਚਾਣ ਬਣ ਚੁੱਕਾ ਹੈ ਅਤੇ ਇਹ ਨੌਜਵਾਨਾਂ ਵਿੱਚ ਵੀ ਬਹੁਤ ਮਸ਼ਹੂਰ ਹੈ ਭੰਗੜਾ ਸਿਰਫ ਨੱਚਣ ਦੀ ਕਰਾਂ ਨਹੀਂ ਇੱਕ ਵਧੀਆ ਕਸਰਤ ਹੈ ਜੋ ਸਰੀਰ ਨੂੰ ਤੰਦਰੁਸਤ ਅਤੇ ਮਨ ਨੂੰ ਤਾਜ਼ਗੀ ਦਿੰਦੀ ਹੈ ਧੰਨਵਾਦ